ਸ਼ਾਸਤਰੀ ਸੰਗੀਤ ਸਾਨੂੰ ਬਚਪਨ ਤੋਂ ਹੀ ਬਹੁਤ ਪਸੰਦ ਆ ਅਸੀਂ ਸਕੂਲ ਟੈਮ ਤੋਂ ਹੀ ਸ਼ਾਸਤਰੀ ਸੰਗੀਤ ਸੁਣਦੇ ਰਹੇ ਹਾਂ ਅਤੇ ਗਾਉਂਦੇ ਵੀ ਰਹੇ ਆ ਸਾਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਪਰ ਸਾਡੀ ਆਵਾਜ਼ ਥੋੜ੍ਹੀ ਜਿਹੀ ਠੀਕ ਨਾ ਹੋਣ ਕਰਕੇ ਅਸੀਂ ਚਲੋ ਗਾਈ ਦਾ ਹੈਗਾ ਵਾ ਪਰ ਇਹ ਆ ਬਈ ਥੋੜ੍ਹਾ ਗਾਈਦਾ ਵਾ ਅਤੇ ਪਰ ਸਾਨੂੰ ਸੁਣਨ ਦੇ ਵਿੱਚ ਰੁਚੀ ਬਹੁਤ ਜ਼ਿਆਦੀ ਹੈ ਸ਼ਾਸਤਰੀ ਸੰਗੀਤ ਦੀ ਸ਼ਾਸਤਰੀ ਸੰਗੀਤ ਸਾਨੂੰ ਬਹੁਤ ਸੋਹਣਾ ਲੱਗਦਾ ਵਾ ਇਹਦੇ ਸੌਂਗ ਜਿਹੜੇ ਹੁੰਦੇ ਆ ਪਰਿਵਾਰ ਵਿੱਚ ਬਹਿ ਕੇ ਸੁਣਨ ਵਾਲੇ ਹੁੰਦੇ ਆ ਅਤੇ ਹਰ ਕੋਈ ਇਸ ਸ਼ਾਸਤਰੀ ਸੰਗੀਤ ਨੂੰ ਪਸੰਦ ਕਰਦਾ ਵਾ ਇਸ ਤੋਂ ਸਮਕਾਲੀ ਸੰਗੀਤ ਜਿਹੜਾ ਹੈਗਾ ਵਾ ਉਹ ਅਸੀਂ ਬਹੁਤ ਘੱਟ ਪਸੰਦ ਕਰਦੇ ਹਾਂ ਕਿਉਂਕਿ ਸਾਨ ਅਸੀਂ ਸ਼ੁਰੂ ਤੋਂ ਹੀ ਦੂਸਰਾ ਸ਼ਾਸਤਰੀ ਸੰਗੀਤ ਸੁਣਦੇ ਆ ਰਹੇ ਹਾਂ ਅਤੇ ਸਾਡੇ ਮਨ ਵਿੱਚ ਉਹੀ ਚੰਗਾ ਲੱਗਦਾ ਵਾ ਅਤੇ ਅਸੀਂ ਹਰੇਕ ਨੂੰ ਇਹੋ ਪ੍ਰੇਰਿਤ ਕਰਦੇ ਹਾਂ ਬਈ ਤੁਸੀਂ ਵੀ ਸ਼ਾਸਤਰੀ ਸੰਗੀਤ ਸੁਣਿਆ ਕਰੋ ਜੇ ਕਿਸੇ ਨੂੰ ਸਮਕਾਲੀ ਸੰਗੀਤ ਪਸੰਦ ਆ ਅਤੇ ਅਸੀਂ ਉਹ ਵੀ ਉਹਨਾਂ ਨਾਲ ਵੀ ਪੂਰਾ ਸਾਥ ਦਿੰਦੇ ਹਾਂ